ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਹਾਂ ਠੀਕ ਹੈ ਭੈਣ ਜੀ ਤੁਹਾਨੂੰ ਪਤਾ ਸਾਡੇ ਇੱਥੇ ਮੂਵੀ ਦੀ ਸ਼ੂਟਿੰਗ ਹੋਣ ਲੱਗੀ ਅਕਸ਼ੈ ਕੁਮਾਰ ਦੀ ਮੇਲੇ ਵਿੱਚ ਸੁਣਿਆ ਸੀ ਪਹਿਲਾਂ ਤੁਸੀਂ ਬਾਰੇ ਅਤੇ ਚਲੀਏ ਫਿਰ ਦੇਖਣ ਅਸੀਂ ਚਲੋ ਠੀਕ ਹੈ ਫਿਰ ਤੁਸੀਂ ਕਦੋਂ ਤੱਕ ਫ੍ਰੀ ਹੋਣਾ ਵੈਸੇ ਠੀਕ ਹੈ ਹਾਂ ਅਸੀਂ ਨਾ ਸ਼ਾਮੀ ਜਾਵਾਂਗੇ ਪੰਜ ਵਜੇ ਤੋਂ ਬਾਅਦ ਪਹਿਲਾਂ ਰੱਸ਼ ਕਾਫ਼ੀ ਹੁੰਦਾ ਹੈ ਨਾ ਬੰਦੇ ਬੜੇ ਹੁੰਦੇ ਆ ਉੱਥੇ ਹਾਂਜੀ ਹਾਂਜੀ ਸਟੂਡੈਂਟ ਵੀ ਕਾਫ਼ੀ ਹੁੰਦੇ ਆ ਤਾਂ ਪੰਜ ਵਜੇ ਤੋਂ ਬਾਅਦ ਅਸੀਂ ਚੱਲਾਂਗੇ ਠੀਕ ਆ ਦੇਖਣ ਤੁਸੀਂ ਹੋਰ ਕਿਸੇ ਨੂੰ ਨਾਲ ਲੈ ਕੇ ਜਾਣਾ ਚੱਲ ਚਲੋ ਠੀਕ ਹੈ ਆਪਾਂ ਸਕੂਟੀ 'ਤੇ ਚੱਲ ਜਾਂਗੇ ਦੋਨੇ ਜਣੇ ਠੀਕ ਆ ਹਾਂ ਵਧੀਆ ਹੈ ਕਹਿੰਦੇ ਫਿਲਮ ਵੀ ਵਧੀਆ ਆ ਸਾਰਾਗੜ੍ਹੀ ਫਿਲਮ ਆ ਸਾਰਾਗੜ੍ਹੀ ਬੇਸ 'ਤੇ ਅਤੇ ਦੇਖ ਕੇ ਆਉਂਦੇ ਸਾਡੇ ਸ਼ਹਿਰ ਵਿੱਚ ਵੈਸੇ ਵੀ ਪਹਿਲੀ ਵਾਰੀ ਹੋਣ ਲੱਗੀ ਆ ਜਾਂਦੇ ਦੇਖ ਕੇ ਆਉਂਦੇ ਹਾਂ ਠੀਕ ਹੈ ਹਾਂ ਓਕੇ ਜੀ